ਹਾਂਜੀ ਹੈਲੋ ਹਾਂਜੀ ਹਾਂਜੀ ਪੰਜਾਬ ਖੇਤਰ ਤੋਂ ਬੋਲਦੇ ਹੋ ਹਾਂਜੀ ਅੱਛਾ ਅੱਛਾ ਅੱਛਾ ਜੀ ਅਸੀਂ ਤੁਹਾ ਤੁਹਾਡੇ ਕੋਲੋਂ ਪਹਿਲਾਂ ਬੀਜ ਲੈ ਗਏ ਸੀਗੇ ਖੇਤੀਬਾੜੀ ਵਾਸਤੇ ਅਤੇ ਆਪਣੇ ਕਈ ਜਿਨਸਾਂ ਦੇ ਬੀਜ ਸੀ ਅਤੇ ਜਿਹਦੇ ਵਿੱਚ ਝੋਨੇ ਦਾ ਬੀਜ ਵੀ ਸੀਗਾ ਅਤੇ ਝੋਨੇ 'ਚ ਹਾਂ ਉਹ ਬੀਜ ਸਾਨੂੰ ਬਹੁਤੇ ਚੰਗੇ ਨਹੀਂ ਮਿਲੇ ਇਸ ਕਰਕੇ ਸਾਡੇ ਆਪਣੇ ਫਸਲ ਦੇ ਵਿੱਚ ਬੀਜ ਦਾ ਬਹੁਤ ਸਾਨੂੰ ਫਸਲ ਦਾ ਘਾਟਾ ਪੈ ਗਿਆ ਅਤੇ ਹੁਣ ਤੁਹਾਡੇ ਕੋਲੋਂ ਅਸੀਂ ਝੋਨੇ ਦਾ ਬੀਜ ਲੈ ਕੇ ਗਏ ਹਾਂ ਉਹ ਵੀ ਆਪਣਾ ਵਿੱਚ ਅਤੇ ਮਿਲਾਵਟ ਵਾਲਾ ਬੀਜ ਸੀ ਉਹ ਚੰਗੇ ਬੀਜ ਨਹੀਂ ਸੀਗਾ ਹਾਂਜੀ ਇਸ ਕਰਕੇ ਸਾਨੂੰ ਬਹੁਤ ਘਾਟਾ ਪਿਆ ਹੁਣ ਸਾਨੂੰ ਤੁਸੀਂ ਜੇ ਬੀਜ ਚੰਗਾ ਪਏ ਅੱਛਾ ਚਲੋ ਉਹ ਤਾਂ ਠੀਕ ਆ ਹਾਂ ਹੁਣ ਫਿਰ ਤੁਹਾਡੇ ਕੋਲੋਂ ਹੀ ਲੈ ਕੇ ਜਾਵਾਂਗੇ ਬੀਜ ਅੱਛਾ ਠੀਕ ਹੈ ਅਤੇ ਝੋਨੇ ਦਾ ਬੀਜ ਚੰਗਾ ਦਿਓ ਸਾਨੂੰ ਚੰਗਾ ਝੋਨਾ ਅੱਛਾ ਠੀਕ ਹੈ ਚੰਗੇ ਬੀਜ ਨਾਲ ਚੰਗਾ ਝਾੜ ਨਿਕਲਦਾ ਜੀ ਇਸ ਕਰਕੇ ਅਸੀਂ ਆਪਦਾ ਹਾਂ ਚੰਗੇ ਹਾਂ ਚੰਗਾ ਮਾਰਕੀਟ ਦੇ ਵਿੱਚ ਜਾ ਕੇ ਹਾਂਜੀ ਹਾਂਜੀ ਅਤੇ ਇਸ ਕਰਕੇ ਮੈਂ ਤੁਹਾਨੂੰ ਹੋਰ ਵੀ ਹਾਂ ਹੁਣ ਵੀ ਤੁਹਾਨੂੰ ਚੰਗੇ ਬੀਜ ਦੇਖਿਓ ਦਿਓ ਜਿਹੜੇ ਅਸੀਂ ਆਪਦੀ ਆਮਦਨ ਵੱਧ ਕੱਢੀਏ ਵੱਧ ਕਰੀਏ ਸਾਰਾ ਕੁਝ ਬੀਜ ਦੇ ਸਿਰ 'ਤੇ ਫਸਲ ਹੁੰਦੀ ਹੈ ਜੀ ਹਾਂ ਜੇ ਬੀਜ ਮਾੜੇ ਤਾਂ ਹਾਂ ਉਹ ਤੁਹਾਡੀ ਅਸੀਂ ਕੰਪਲੇਂਟ ਕਰਨੀ ਸੀ ਪਰ ਫਿਰ ਅਸੀਂ ਸੋਚਿਆ ਵੀ ਚਲੋ ਇਹ ਗਲਤੀ ਹੋ ਜਾਂਦੀ ਇੱਕ ਦੋ ਵਾਰੀ ਫਿਰ ਗਾਂਹ ਨੂੰ ਉਹ ਚੰਗਾ ਲੈ ਆਵਾਂਗੇ ਚਲ ਜਾ ਕੇ ਇਸ ਕਰਕੇ ਫਿਰ ਹਾਂ ਹਾਂ ਕੋਈ ਨਹੀਂ ਆਵਾਂਗੇ ਇੱਕ ਦਿਨ ਤਾਂ ਕਰਕੇ ਫਿਰ ਲੈ ਕੇ ਜਾਵਾਂਗੇ ਤੁਹਾਡੇ ਕੋਲੋਂ ਬੀਜ ਹਾਂ

ਹੈਂ ਜੀ